ਹੈਲੋ ਹਾਂਜੀ ਭਾਅ ਜੀ ਸ਼ਕਤੀ ਕੈਬ ਪਰ ਤੋਂ ਬੋਲ ਰਹੇ ਹੋ ਹਾਂਜੀ ਉਹ ਮੈਂ ਤੁਹਾਨੂੰ ਕਹਿਣਾ ਸੀ ਕਿ ਕੱਲ੍ਹ ਮੈਂ ਇਕ ਰਾਤ ਕੈਬ ਬੁੱਕ ਕਰਵਾਈ ਸੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਮੇਰੀ ਬੇਟੀ ਨੇ ਜਾਣਾ ਸੀਗਾ ਕਨੇਡਾ ਦਿੱਲੀ ਅਸੀਂ ਪਹੁੰਚਾਉਣਾ ਉਥੋਂ ਦੀ ਫਲੈਟ ਹੈਗੀ ਕਨੇਡਾ ਦੀ ਅਤੇ ਸਵੇਰ ਤੋਂ ਅਸੀਂ ਜਾਣਾ ਵੀ ਜ਼ਰੂਰੀ ਯਾਤਰਾ ਹੈਗੀ ਸਾਡੀ ਦੇਖੋ ਉਹ ਮੈਂ ਸਵੇਰ ਤੋਂ ਫੋਨ ਕਰੀ ਜਾਂਦੀ ਪਈ ਹਾਂ ਫੋਨ ਨਹੀਂ ਚੁੱਕਣ ਦਿਆ ਉਹ ਹਾਂ ਹਾਂ ਮੈਂ ਤਿੰਨ ਚਾਰ ਵਾਰੀ ਫੋਨ ਕਰ ਚੁੱਕੀ ਹਾਂ ਮੈਂ ਬੜੀ ਪਰੇਸ਼ਾਨ ਹੋਈ ਹਾਂ ਹਾਂ ਇਸੇ ਪਿੱਛੇ ਤੁਹਾਨੂੰ ਫੋਨ ਕੀਤਾ ਕਿ ਕੀ ਗੱਲ ਕੀ ਆ ਦੇਖੋ ਨਾ ਬੰਦੇ ਨੂੰ ਫੋਨ ਤਾਂ ਚੁੱਕਣਾ ਚਾਹੀਦਾ ਨਾ ਮੈਂ ਐਮਰਜੰਸੀ ਹੁੰਦੀ ਹੈ ਕੋਈ ਜਾਂ ਤਾਂ ਫਿਰ ਰਾਤ ਮੈਨੂੰ ਦੱਸ ਦਿੰਦਾ ਕਿ ਮੈਂ ਨਹੀਂ ਜਾ ਸਕਦਾ ਕੋਈ ਨਾ ਕੋਈ ਹੋਰ ਇੰਤਜ਼ਾਮ ਕਰਦੀ ਮੈਂ ਇੰਨੀ ਮੁਸ਼ਕਿਲ ਆ ਰਹੀ ਆ ਹਾਂ ਹਾਂ ਦੇਖੋ ਇਹੋ ਜਿਹੇ ਹਾਂ ਤੁ ਹਾਂ ਹਾਂ ਤੁਸੀਂ ਨਹੀਂ ਨਹੀਂ ਤੁਸੀਂ ਦੇਖੋ ਉਹਨਾ ਨੂੰ ਜਾਂ ਤਾਂ ਤੁਸੀਂ ਫੋਨ ਕਰਕੇ ਪੁੱਛੋ ਅਤੇ ਕਿਉਂਕਿ ਮੈਂ ਤਾਂ ਬਹੁਤ ਪਰੇਸ਼ਾਨ ਓ ਪਰੇਸ਼ਾਨ ਹੋਈ ਜਾ ਰਹੀ ਹਾਂ ਜਾਂ ਤੁਸੀਂ ਦੇਖੋ ਉਹਨੂੰ ਕੀ ਕਰ ਰਿਹਾ ਨਹੀਂ ਤਾਂ ਫਿਰ ਮੈਂ ਆਪਣਾ ਇਹ ਕੈਂਸਲ ਕਰਾਵਾਂ ਅਤੇ ਕੋਈ ਹੋਰ ਇੰਤਜਾਮ ਕਰਾਂ ਮੈਨੂੰ ਜਲਦੀ ਤੋਂ ਜਲਦੀ ਦੱਸੋ ਤਾਂ ਕਿ ਮੈਂ ਇਹ ਫੈਸਲਾ ਜਲਦੀ ਲੈ ਲਵਾਂ ਜਾਣਾ ਵੀ ਬਹੁਤ ਜ਼ਰੂਰੀ ਹੈ